ਬਾਹਰੋਂ ਆਏ ਹੋਏ ਇੰਗਲੈਂਡ ਤੋਂ ਆਏ ਇਨਸਾਨ ਨੇ ਜਦੋਂ ਕਿ ਉਸ ਨੂੰ ਸਾਨੂੰ ਉਸਦੀ ਭਾਸ਼ਾ ਸਮਝ ਨਾ ਆਈ ਤਾਂ ਅਸੀਂ ਉਸਨੂੰ ਆਪਣੇ ਪੰਜਾਬੀ ਤੌਰ ਤਰੀਕਿਆਂ ਨਾਲ ਉਹਨੂੰ ਸਮਝਾਇਆ ਤਾਂ ਉਹਨੂੰ ਬਿਲਕੁਲ ਸਮਝ ਆ ਗਈ ਤਾਂ ਉਸਨੇ ਸਾਡੇ ਕੋਲ ਬਹੁਤ ਸੋਹਣਾ ਅਨੁਭਵ ਲਿਆ ਪੰਜਾਬੀ ਭਾਸ਼ਾ ਦਾ ਫਿਰ ਅਸੀਂ ਉਹਨੂੰ ਕਿੰਨਾਂ ਕੁਝ ਸਿਖ ਸਿਖਾਉਣਾ ਪਿਆ ਜਿਹਨੂੰ ਕਿ ਉਹ ਉਹ ਬਹੁਤ ਜਲਦੀ ਉਹਨੇ ਪੰਜਾਬ ਪੰਜਾਬੀ ਵਿੱਚ ਉਹਨੂੰ ਸੰਭਵ ਕਰ ਲਿਆ ਤਾਂ ਉਸਨੇ ਬਹੁਤ ਕੁਝ ਸਿੱਖ ਲਿਆ ਪੰਜਾਬੀ ਵਿੱਚ